ਮੈਂ ਕੋਈ ਪ੍ਰੋਫੈਸ਼ਨਲ ਸਿੰਗਰ ਨਹੀਂ ਹਾਂ ਅਤੇ ਨਾ ਮੈਂ ਕੋਈ ਰਿਕਾਰਡਿੰਗ ਕਰਦੀ ਹਾਂ ਗਾਣਿਆਂ ਦੀ ਮੈਨੂੰ ਬਸ ਐਵੇਂ ਹੀ ਤੁਰਦੇ ਫਿਰਦੇ ਗੁਣਗੁਣਾਉਣਾ ਪਸੰਦ ਹੈ ਮੈਨੂੰ ਗਾਣਾ ਸੁਣਨਾ ਜ਼ਿਆਦਾ ਪਸੰਦ ਹੈ ਜੇਕਰ ਦਿਲ ਕਰੇ ਤਾਂ ਦੋਸਤਾਂ ਨਾਲ ਬੈਠ ਕੇ ਆਪਾਂ ਗਾ ਵੀ ਲਈਦਾ ਹੈ ਅਤੇ ਜਦੋਂ ਪਰਿਵਾਰ ਨਾਲ ਹੁੰਦੇ ਹਾਂ ਉਦੋਂ ਆਪਾਂ ਪੁਰਾਣੇ ਗਾਣੇ ਕਿਸ਼ੋਰ ਕੁਮਾਰ ਦੇ ਗਾ ਲੈਂਦੇ ਹਾਂ ਜਾਂ ਫਿਰ ਕੋਈ ਗ਼ਜ਼ਲਾਂ ਗਾ ਲੈਂਦੇ ਹਾਂ ਅਤੇ ਰਹੀ ਗੱਲ ਸੁਣਨ ਦੀ ਮੈਨੂੰ ਸੂਫੀ ਗਾਣੇ ਬਹੁਤ ਪਸੰਦ ਹਨ ਉਹ ਮੈਨੂੰ ਬਹੁਤ ਸੁਕੂਨ ਦਿੰਦੇ ਹੈ ਮੈਨੂੰ ਜ਼ਿਆਦਾ ਸ਼ੋਰ ਵਾਲੇ ਉੱਚੀ ਉੱਚੀ ਬੀਟ ਵਾਲੇ ਗਾਣੇ ਇੰਨੇ ਪਸੰਦ ਨਹੀਂ ਹੈ ਅਤੇ ਮੈਂ ਸਿਰਫ਼ ਹਿੰਦੀ ਅਤੇ ਪੰਜਾਬੀ ਗਾਣੇ ਸੁਣਦੀ ਹਾਂ ਅਤੇ ਗਾਉਂਦੀ ਹਾਂ